ਹੈਲੋ ਤੁਸੀਂ ਸਿੰਘ ਟ੍ਰੈਵਲਸ ਤੋਂ ਬੋਲ ਰਹੇ ਹੋ ਮੈਨੂੰ ਦੋ ਦਿਨ ਬਾਅਦ ਨੈਣਾ ਦੇਵੀ ਜਾਣਾ ਹੈ ਕਿਆ ਤੁਸੀਂ ਆ ਸਕਦੇ ਹੋ ਅਤੇ ਮੈਂ ਸ਼ਾਮਪੁਰਾ ਛੋਟੀ ਹਵੇਲੀ ਵਿੱਚ ਰਹਿਣ ਵਾਲੀ ਹਾਂ ਤੁਸੀਂ ਮੈਨੂੰ ਉਸ ਜਗ੍ਹਾ ਤੋਂ ਪਿੱਕ ਕਰ ਸਕਦੇ ਹੋ ਦੈਨ ਮੇਰੇ ਨਾਲ ਮੇਰੇ ਮੰਮੀ ਪਾਪਾ ਬ੍ਰਦਰ ਸਿਸਟਰ ਹੈ ਅਸੀਂ ਪੰਜ ਜਣੇ ਹਾਂ ਅਤੇ ਤੁਸੀਂ ਆਪਣਾ ਕਿਰਾਇਆ ਮੈਨੂੰ ਬਆਦ ਵਿੱਚ ਦੱਸ ਦਿਉ